ਵੱਖ ਵੱਖ ਪਕਵਾਨਾਂ ਨੂੰ ਪਕਵਾਉਣ ਦਾ ਆਪਣਾ ਅਨੁਭਵ ਮੈਂ ਤੁਹਾਨੂੰ ਦੱਸਦੀ ਹਾਂ ਜਿਵੇਂ ਕਿ ਮੈਨੂੰ ਪਨੀਰ ਦੀ ਸਬਜ਼ੀ ਬਣਾਉਣੀ ਬੜੀ ਵਧੀਆ ਲੱਗਦੀ ਆ ਥੋੜ੍ਹੇ ਜਿਹੇ ਗੰਢੇ ਕੱਟੋ ਇਹਨੂੰ ਚੰਗੀ ਤਰ੍ਹਾਂ ਭੁੰਨੋ ਤਾਂ ਪੰਦਰਾਂ ਵੀਹ ਮਿੰਟ ਦੇ ਵਿੱਚ ਆਪਾਂ ਇਹ ਸਬਜ਼ੀ ਤਿਆਰ ਕਰ ਲੈਂਦੇ ਹਾਂ ਕੋਈ ਭੈਣ ਭਰਾ ਵੀ ਆਪਣਾ ਆਇਆ ਹੋਵੇ ਥੋੜ੍ਹੇ ਸਮੇਂ ਦੇ ਵਿੱਚ ਹੀ ਆਪਾਂ ਉਹਨੂੰ ਰੋਟੀ ਤਿਆਰ ਕਰਕੇ ਦੇ ਸਕਦੇ ਹਾਂ ਦੂਜੀ ਗੱਲ ਆਲੂ ਗਾਜਰਾਂ ਦੀ ਸਬਜ਼ੀ ਜਿਹੜੀ ਆ ਇਹ ਵੀ ਪੰਦਰਾਂ ਵੀਹ ਮਿੰਟ ਦੇ ਵਿੱਚ ਵਿੱਚ ਆਪਣੇ ਕੋਲੋਂ ਤਿਆਰ ਹੋ ਜਾਂਦੀ ਹੈ ਗੰਡ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲਓ ਥੋੜ੍ਹਾ ਜਿਹਾ ਵਿੱਚ ਪਾਣੀ ਪਾਓ ਇਹ ਵੀ ਸਬਜ਼ੀ ਤਿਆਰ ਹੋ ਜਾਂਦੀ ਹੈ ਮੂੰਗੀ ਮਸਰਾਂ ਦੀ ਦਾਲ ਜਿਹੜੀ ਆ ਉਹ ਤਾਂ ਬਹੁਤ ਹੀ ਘੱਟ ਸਮੇਂ ਦੇ ਵਿੱਚ ਆਪਾਂ ਤਿਆਰ ਕਰ ਸਕਦੇ ਹਾਂ ਇੱਕ ਜਿਹੜੀ ਦਾਲ ਹੈ ਇਹ ਨਰੋਈ ਹੁੰਦੀ ਆ ਦੂਜੀ ਇਹ ਆ ਕਿ ਪੰਦਰਾਂ ਵੀਹ ਮਿੰਟ ਦੇ ਵਿੱਚ ਬਣ ਜਾਂਦੀ ਹੈ ਦ ਮਹਾਂ ਛੋਲਿਆਂ ਦੀ ਦਾਲ ਹੈ ਇਹਨੂੰ ਵੀ ਆਪਾਂ ਬੜੇ ਆਸਾਨ ਤਰੀਕੇ ਦੇ ਨਾਲ ਕੂਕਰ ਦੇ ਵਿੱਚ ਪੰਦਰਾਂ ਵੀਹ ਤੋਂ ਪੱਚੀ ਮਿੰਟ ਦੇ ਵਿੱਚ ਵਿੱਚ ਤਿਆਰ ਕਰ ਸਕਦੇ ਹਾਂ ਸਾਰੀਆਂ ਸਬਜ਼ੀਆਂ ਜਿੱਦਾਂ ਸੌਖੀਆਂ ਹੁੰਦੀਆਂ ਵਾ ਗੈਸ 'ਤੇ ਤਾਂ ਜਲਦੀ ਹੀ ਤਿਆਰ ਹੋ ਜਾਂਦੀਆਂ ਵਾ ਆਲੂ ਆ ਇਹਨਾਂ ਨੂੰ ਵੀ ਆਪਾਂ ਉਬਾਲ ਕੇ ਬਣਾਉਂਦੇ ਹਾਂ ਤਾਂ ਇਹ ਵੀ ਜਲਦੀ ਤਿਆਰ ਹੋ ਜਾਂਦੇ ਆ ਜਿਵੇਂ ਕਿ ਭਿੰਡੀਆਂ ਹੋ ਗਈਆਂ ਹੁਣ ਜਿਵੇਂ ਗਰਮੀ ਦਾ ਮੌਸਮ ਆਉਣ ਡਿਆ ਵਾ ਇਹਦੇ ਵਿੱਚ ਤੋਰੀਆਂ ਵਾ ਤੋਰੀਆਂ ਥੋੜ੍ਹੀਆਂ ਜਿਹੀਆਂ ਹੀ ਆਪਾਂ ਲੈਂਦੇ ਹਾਂ ਇਹਨਾਂ ਨੂੰ ਧਰਦੇ ਹਾਂ ਅੱਧੇ ਘੰਟੇ ਦੇ ਵਿੱਚ ਆਪਣੀ ਸਬਜ਼ੀ ਤਿਆਰ ਹੋ ਜਾਂਦੀ ਹੈ ਭਿੰਡੀਆਂ ਤੋਰੀਆਂ ਕੱਦੂ ਹੁਣ ਇਹੋ ਜਿਹੀਆਂ ਸਬਜ਼ੀਆਂ ਆ ਜਾਣੀਆਂ ਇਹਨਾਂ ਨੂੰ ਆਪਾਂ ਜਲਦੀ ਹੀ ਤਿਆਰ ਕਰ ਲੈਣਾ ਹੁੰਦਾ ਵਾ ਦੂਜੀ ਗੱਲ ਜੇ ਔਖੇ ਪਕਵਾਨਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਰੋਂ ਦਾ ਸਾਗ ਸ਼ਲਗਮ ਇਹ ਥੋੜ੍ਹਾ ਮੈਨੂੰ ਔਖੇ ਲੱਗਦੇ ਹੈ ਇਹ ਔਖੇ ਇਸ ਕਰਕੇ ਲੱਗਦੇ ਆ ਇੱਕ ਤਾਂ ਇਹਨਾਂ ਨੂੰ ਆਪਾਂ ਨੂੰ ਖੇਤ ਦੇ ਵਿੱਚ ਜਾ ਕੇ ਲਿਆਉਣਾ ਪੈਂਦਾ ਵਾ ਅਤੇ ਚੰਗੀ ਤਰ੍ਹਾਂ ਧੋਣਾ ਪੈਂਦਾ ਵਾ ਫਿਰ ਇਹਨਾਂ ਨੂੰ ਬਣਾਉਣਾ ਪੈਂਦਾ ਵਾ ਫਿਰ ਕੂਕਰ ਦੇ ਵਿੱਚ ਕਈ ਜਿਹੜੇ ਆਮ ਸ਼ਹਿਰੀ ਲੋਕ ਆ ਉਹ ਤਾਂ ਇਹਨੂੰ ਕੂਕਰ ਦੇ ਵਿੱਚ ਬਣਾਉਂਦੇ ਆ ਪਰ ਇਹ ਆ ਕਿ ਕੂਕਰ 'ਚ ਇਹ ਸਹੀ ਨਹੀਂ ਬਣਦੇ ਇਹਨੂੰ ਚੁੱਲੇ ਦੇ ਵਿੱਚ ਹੀ ਆਪਾਂ ਅੱਗ ਬਾਲ ਕੇ ਸਾਗ ਨੂੰ ਬਣਾਉਂਦੇ ਹਾਂ ਤਾਂ ਜ਼ਿਆਦਾ ਵਧੀਆ ਬਣਦਾ ਵਾ ਚਾਰ ਪੰਜ ਘੰਟੇ ਇਹਨੂੰ ਰਿੰਨਣਾ ਪੈਂਦਾ ਵਾ ਫਿਰ ਇਹਨੂੰ ਘੋਟਣਾ ਪੈਂਦਾ ਵਾ ਆਪਣੇ ਕਿ ਪੰਜ ਛੇ ਘੰਟੇ ਲੱਗ ਜਾਂਦੇ ਆ ਬਣਦਾ ਸਵਾਦ ਆ ਪਰ ਸਮਾਂ ਬਹੁਤ ਖਰਾਬ ਹੁੰਦਾ ਹੈ ਉਵੇਂ ਹੀ ਜਿਵੇਂ ਸ਼ਲਗਮ ਆ